ਪੰਜਾਬੀ ਮੇਰੀ ਮਾਤ ਭਾਸ਼ਾ ਹੈ ਇਹ ਭਾਸ਼ਾ ਬਹੁਤ ਹੀ ਸੌਖੀ ਅਤੇ ਮਿੱਠੀ ਹੈ ਇਸ ਗੱਲ ਨੂੰ ਅਸੀਂ ਨਿਕਾਰ ਨਹੀਂ ਸਕਦੇ ਇਹ ਗੁਰ ਭਾਸ਼ਾ ਗੁਰਮੁੱਖੀ ਲਿਪੀ ਤੋਂ ਅੱਗੇ ਉਪਜੀ ਹੈ ਇਸ ਦਾ ਲਿਖਤ ਰੂਪ ਵੀ ਗੁਰਮੁੱਖੀ ਲਿਪੀ ਵਿੱਚੋਂ ਆਇਆ ਹੈ ਇਸ ਦੀ ਵਿਆਕਰਨ ਵੀ ਬਹੁਤ ਹੀ ਜ਼ਿਆਦਾ ਵੱਖਰੀ ਹੈ ਜਿਵੇਂ ਕਿ ਇਸ ਵਿੱਚ ਸਾਨੂੰ ਨਾਸਕੀ ਨਾਸਕੀ ਸ਼ਬਦ ਵੇਖਣ ਨੂੰ ਮਿਲਦੇ ਹਨ ਜੋ ਜ਼ਿਆਦਾਤਰ ਭਾਸ਼ਾਵਾਂ ਵਿੱਚ ਨਹੀਂ ਹੁੰਦੇ ਇਸ ਦੀ ਵਿਆਕਰਨ ਬਹੁਤ ਸੌਖੀ ਹੈ ਅਤੇ ਇਸ ਨੂੰ ਇਸ ਵਿੱਚ ਮਾਤਰਾਵਾਂ ਦੀ ਵੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਜੋ ਬਹੁਤ ਘੱਟ ਭਾਸ਼ਾਵਾਂ ਵਿੱਚ ਵੇਖਣ ਨੂੰ ਮਿਲਦੀ ਹੈ